ਹੈਲੋ ਹਾਂਜੀ ਸਰਦਾਰ ਗੁਰਦੀਪ ਸਿੰਘ ਜੀ ਬੋਲ ਰਹੇ ਨੇ ਫਤਿਹ ਰਾਈਸ ਮਿੱਲ ਤੋਂ ਹਾਂਜੀ ਹਾਂਜੀ ਫ ਫਤਿਹਗੜ੍ਹ ਸਾਹਿਬ ਤੋਂ ਹਾਂਜੀ ਠੀਕ ਠੀਕ ਠੀਕ ਹੈ ਜੀ ਠੀਕ ਆ ਅੱਛਾ ਆਪਾਂ ਨੇ ਨਾ ਅਪ ਆਪਣੇ ਕੋਲ ਹੈਗੀਆਂ ਗਿਆਰ੍ਹਾਂ ਇੱਕੀ ਆ ਕੁਛ ਪੈਡੀ ਅਤੇ ਪੰਦਰ੍ਹਾਂ ਸੌ ਨੌ ਵੀ ਹੈਗੀ ਆ ਅਤੇ ਬਾਕੀ ਚੌਦ੍ਹਾਂ ਸੌ ਇੱਕ ਹਲੇ ਖੜ੍ਹੀ ਆ ਆਪਣੀ ਉਹ ਹਲੇ ਵੱਢਣੀ ਆ ਆਪਾਂ ਨੇ ਮੈਂ ਤਾਂ ਰੇਟ ਇਹਦਾ ਕੰਨਫਰਮ ਕਰਨਾ ਸੀ ਵੀ ਕਿਵੇਂ ਚਲਦੇ ਨੇ ਰੇਟ ਜੀ ਪੰਦਰ੍ਹਾਂ ਸੌ ਨੌ ਦਾ ਕੀ ਰੇਟ ਆ ਹੁਣ ਮਾਰਕੀਟ ਰੇਟ ਦਾ ਹਾਂਜੀ ਹਾਂਜੀ ਹਾਂਜੀ ਦੱਸੋ ਠੀਕ ਠੀਕ ਆ ਹਾਂ ਠੀਕ ਠੀਕ ਠੀਕ ਆ ਹਾਂ ਚਲੋ ਮੈਚਰ ਹਾਂ ਮੈਚਰ ਕਿੰਨਾਂ ਦੇ ਰਹੇ ਹੋ ਤੁਸੀਂ ਹੁਣ ਨਹੀਂ ਅਠਾਰ੍ਹਾਂ ਤਾਂ ਘੱਟ ਹੈ ਜੀ ਅਠਾਰ੍ਹਾਂ ਦਾ ਆਪਣਾ ਹੁਣ ਫਿਰ ਪਰਮਲ ਦਾ ਚੱਲਦਾ ਰੇਟ ਅਠਾਰ੍ਹਾਂ ਦਾ ਅਤੇ ਇੱਕੀ ਬਾਈ ਤਾਂ ਤੁਸੀਂ ਲਉ ਬਾਸਮਤੀ ਆ ਨਾ ਆਪਣੇ ਕੋਲ ਬਾਸਮਤੀ ਤਾਂ ਫਿਰ ਇੱਕੀ ਬਾਈ ਤਾਂ ਜਾਇਜ਼ ਏ ਹੋਵੇਗਾ ਹਾਂ ਹਾਂ ਹਾਂ ਚਲੋ ਇਹ ਤਾਂ ਸੁੱਕਦੀ ਹੈ ਫਿਰ ਥੋੜ੍ਹੀ ਥੋੜ੍ਹੀ ਤਾਂ ਉਹ ਪਤਾ ਲੱਗਦਾ ਜੀ ਪਰ ਥੋੜ੍ਹਾ ਰੇਟ ਮੈਨੂੰ ਪਤਾ ਲੱਗਿਆ ਸੀ ਮਾਰਕੀਟ ਰੇਟ ਥੋੜ੍ਹਾ ਜਿਹਾ ਅੱਪ ਜਾ ਰਿਹਾ ਹੁਣ ਨਾ ਜਿਵੇਂ ਬੱਤੀ ਤੇਤੀ ਸੌ ਤਾਂ ਚੱਲ ਰਿਹਾ ਸੀ ਹੁਣ ਥੋੜ੍ਹਾ ਜਿਹਾ ਅੱਪ ਜਾ ਰਿਹਾ ਵੀ ਕਦੋਂ ਤੁਹਾਨੂੰ ਕੀ ਲੱਗਦੀ ਸੰਭਾਵਨਾ ਵੀ ਅੱਗੇ ਵੱਧਣ ਦੀ ਹੈ ਜੀ ਕੁਛ

ਠੀਕ ਠੀਕ ਆ ਬਾਕੀ ਗਿਆਰ੍ਹਾਂ ਇੱਕੀ ਦਾ ਰੇਟ ਤਾਂ ਕਹਿੰਦੇ ਬਿਆਲੀ ਤਰਤਾਲੀ ਸੌ ਤੱਕ ਚੱਲ ਰਿਹਾ ਮੈਨੂੰ ਲੱਗਦੀ ਹੈਂ ਜੀ ਹਾਂ ਅਤੇ ਗਿਆਰ੍ਹਾਂ ਇੱਕੀ ਵੀ ਆਪਾਂ ਤੁਸੀਂ ਲੈਂਦੇ ਹੋਣੇ ਫਿਰ ਜੀ ਅੱਛਾ ਸਾਰ ਸਾਰੀ ਵਰੈਟੀ ਲੈਂਦੇ ਤੁਸੀਂ ਠੀਕ ਠੀਕ ਆ ਠੀਕ ਠੀਕ ਆ ਇੱਕ ਚੌਦ੍ਹਾਂ ਸੌ ਇੱਕ ਤਾਂ ਆਪਣੇ ਹਲੇ ਵੱਢਣ 'ਤੇ ਖੜ੍ਹੀ ਆ ਜੀ ਫਿਰ ਹਲੇ ਥੋੜ੍ਹੇ ਮੈਚਰ ਹੀ ਹੋਵੇਗਾ ਉਹਦੇ 'ਚ ਉਹਦਾ ਵੀ ਚੌਦ੍ਹਾਂ ਸੌ ਇੱਕ ਦਾ ਵੀ ਰੇਟ ਮੈਨੂੰ ਲੱਗਦੀ ਮੁੱਛਣ ਕਹਿੰਦੇ ਜੀ ਆਪਾਂ ਜਿਹਨੂੰ ਹੈ ਨਾ ਜੀ ਉਹਦਾ ਵੀ ਰੇਟ ਚਾਰ ਹਜ਼ਾਰ ਪਲਸ ਹੀ ਹੋਊ ਮੈਨੂੰ ਲੱਗਦੀ ਅੱਛਾ ਹਿਮਾਚਲ ਠੀਕ ਆ ਜਵੇ ਠੀਕ ਆ ਠੀਕ ਆ ਹਾਂ ਹਾਂ ਹਾਂ ਹਾਂ ਕਿਉਂਕਿ ਹੁਣ ਇੰਟਰਨੈਸ਼ਨਲ ਮਾਰਕੀਟ 'ਚ ਰੇਟ ਤਾਂ ਵਧੇ ਨਹੀਂ ਮੈਨੂੰ ਲੱਗਦੀ ਸਰਕਾਰ ਨੇ ਵੀ ਮਤਲਬ ਜੇ ਕੁਛ ਕਰਤਾ ਹੈ ਨਾ ਵੀ ਹਾਂ ਹਾਂ ਜਦੋਂ ਸਪੋਟ ਕਰਨੀ ਕੁਆਲਟੀ ਫਿਰ ਤਾਂ ਰੇਟ ਤਾਂ ਉਹ ਕੁਆਲਿਟੀ ਤਾਂ ਭਾਲਦੇ ਜੀ ਉਹ ਵਧੀਆ ਠੀਕ ਆ ਮੈਂ ਫਤਿਹਗੜ੍ਹ ਸਾਹਿਬ ਤੋਂ ਹੀ ਬੋਲ ਰਿਹਾਂ ਜੀ ਅਤੇ ਹਾਂ ਬਸ ਠੀਕ ਠੀਕ ਠੀਕ ਚਲੋ ਆਪਾਂ ਮਿਲ ਕੇ ਫਿਰ ਗੱਲ ਕਰਦੇ ਹਾਂ ਠੀਕ ਆ ਜੀ ਠੀਕ ਆ ਜੀ ਓਕੇ ਠੀਕ ਹੈ ਜੀ ਥੈਂਕ ਯੂ